ਅਜੀਤ ਅਖ਼ਬਾਰ ਤੋਂ ਬੋਲਦੇ ਹੈਲੋ ਕੋਣ ਬੋਲਦਾ ਜੀ ਅਸੀਂ ਅਜੀਤ ਅਖ਼ਬਾਰ ਵਾਲੇ ਮੀਡੀਆ ਵਾਲੇ ਬੋਲਦੇ ਹਾਂ ਜੀ ਅਸੀਂ ਨਾ ਤੁਹਾਡੀ ਥੋੜ੍ਹੀ ਇੰਟਰਵਿਊ ਲੈਣੀ ਆ ਵੀ ਜਿਸ ਏਰੀਆ 'ਚ ਤੁਸੀਂ ਬੈਠੇ ਆ ਮਤਲਬ ਕਿ ਇੱਥੇ ਲੋਕ ਕਿੰਨੇ ਕੁ ਵਹਿਮਾ ਭਰਮਾਂ ਦੇ ਵਿੱਚ ਪਏ ਹੋਏ ਆ ਅਤੇ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣੀ ਹੈ ਦੱਸੋਗੇ

ਹਾਂ ਹਾਂ ਹਾਂ ਹਾਂ ਹਾਂ ਠੀਕ ਆ ਇਹ ਮਤਲਬ ਕਿ ਲੋਕ ਬਹੁਤ ਮਤਲਬ ਕਿ ਪਿਛਲੇ ਜ਼ਮਾਨੇ ਦੇ ਹੁਣ ਤਾਂ ਖੈਰ ਪੜ੍ਹੀ ਲਿਖੀ ਆ ਗਈ ਨਾ ਪਨੀਰੀ ਅਤੇ ਅਤੇ ਇਹ ਘੱਟ ਮੰਨਦੇ ਜਿਹੜੇ ਪਿਛਲੇ ਪੁਰਾਣੇ ਬਜ਼ੁਰਗ ਬੈਠੇ ਉਹ ਇਹਨਾਂ ਗੱਲਾਂ ਨੂੰ ਬਹੁਤ ਵਹਿਮ ਕਰਦੇ ਆ ਮਤਲਬ ਕਿ ਕੋਈ ਤਾਂ ਇੰਝ ਵੀ ਕਹਿ ਦਿੰਦਾ ਸਾਡੀ ਜੱਦੀ ਪੀੜ੍ਹੀ ਜਿਹਦੇ 'ਚ ਸਾਡੀ ਮਤਲਬ ਕਿ ਪੀੜ੍ਹੀ ਚੱਲਿਆ ਆ ਰਿਹਾ ਹੈ ਕੁਛ ਇਹ ਸਾਡੇ ਰੀਤੀ ਰਿਵਾਜ਼ ਬਣਾਏ ਹੋਏ ਆ ਹਾਂ ਹੋਰ ਕੋਈ ਇੱਥੇ ਮਤਲਬ ਕਿ ਆਲਾ ਦੁਆਲਾ ਹੋਰ ਮਤਲਬ ਕਿ ਕੋਈ ਪਿੰਡਾਂ ਦੇ ਵਿੱਚ ਹੋਵੇ ਹਾਂ ਆ ਮੜ੍ਹੀ ਮਸਾਣੀ ਨਾ ਜਾਣ ਲੋਕ ਲੋਕਾਂ ਨੂੰ ਤੁਸੀਂ ਮਤਲਬ ਜਾਗਰੂਕ ਕਰੋ ਨਾ ਤੁਸੀਂ ਮਤਲਬ ਇਸ ਕਰਕੇ ਅਸੀਂ ਤੁਹਾਡੀ ਇੰਟਰਵਿਊ ਲੈਂਦੇ ਆ ਵੀ ਤੁਸੀਂ ਮਤਲਬ ਕਿ ਆਪਣੇ ਜਿਹੜਾ ਕੋਈ ਮੁਖੀ ਬੰਦਾ ਹੋਵੇ ਤੁਹਾਡੇ ਪਿੰਡ ਦਾ ਉਹਨੂੰ ਕਹੋ ਵੀ ਇਹ ਜਿਹੜੇ ਵਹਿਮ ਭਰਮ ਜਿਹੜੇ ਇਹ ਕੱਢੋ ਮਤਲਬ ਕਿ ਮਨਾਂ 'ਚੋਂ ਅਗਾਂਹ ਆਉਣ ਵਾਲੇ ਯ ਯੁੱਗ ਦੇ ਵਿੱਚ ਮਤਲਬ ਕਿ ਪੜ੍ਹੇ ਲਿਖੇ ਲੋਕ ਆ ਗਏ ਆ ਕਦੇ ਇਹ ਕੰਮ ਨਾ ਕਰਨ ਮੜ੍ਹੀਆਂ ਮਸਾਣੀਆਂ ਨੂੰ ਪੂਜੋ ਨਾ ਗੁਰਦੁਆਰੇ ਜਾਓ ਜੋ ਆਪਣੇ ਗੁਰੂ ਦੀ ਜੋ ਕਹਿਣ ਵਾਲੀ ਮਤਲਬ ਕਿ ਮੰਨਣ ਵਾਲੀ ਗੱਲ ਉਹ ਮੰਨੋ ਬਸ ਅਸੀਂ ਤੁਹਾਡੇ ਇਹ ਹੀ ਜਾਣਕਾਰੀ ਲੈਣੀ ਸੀ ਤੁਹਾਡੇ ਕੋਲੋਂ